ਕਿਹੜਾ ਪੰਛੀ ਕਿੱਥੇ ਰਹਿੰਦਾ ਹੈ ਕੁਝ ਪੰਛੀ ਆਲ੍ਹਣੇ ਵਿੱਚ ਰਹਿੰਦੇ ਹਨ ਉਹਨਾਂ ਦੇ ਆਲ੍ਹਣੇ ਬਣਾਉਣ ਦੀ ਪ੍ਰਕਿਰਿਆ ਕੀ ਹੈ ਕੁਝ ਪੰਛੀ ਆਲ੍ਹਣਾ ਦਰੱਖਤਾਂ ਉੱਤੇ ਕੁਝ ਪਕਛੀ ਘਰਾਂ ਦੀਆਂ ਖਿੜਕੀਆਂ ਰੋਸ਼ਨਦਾਨ ਦੇ ਉੱਤੇ ਆਲ੍ਹਣਾ ਬਣਾਉਂਦੇ ਹਨ ਜੋ ਕਿ ਆਪਣੇ ਲਈ ਸੁਰੱਖਿਆ ਦਾ ਕੰਮ ਕਰਦਾ ਹੈ ਆਲ੍ਹਣਾ ਬਣਾਉਣ ਲਈ ਉਹਨਾਂ ਨੂੰ ਬਾਰਿਸ਼ ਤੋਂ ਬਚਣ ਦੀ ਮਦਦ ਮਿਲਦੀ ਹੈ ਤੂਫਾਨ ਤੋਂ ਬਚਣ ਦੀ ਮਦਦ ਮਿਲਦੀ ਹੈ ਹਨੇਰੀ ਤੋਂ ਬਚਣ ਦੀ ਮਦਦ ਮਿਲਦੀ ਹੈ ਆਲ੍ਹਣੇ ਵਿੱਚ ਉਹਨਾਂ ਦੇ ਅੰਡੇ ਵੀ ਪਏ ਹੁੰਦੇ ਹਨ ਜਦੋਂ ਉਹਨਾਂ ਦੇ ਬੱਚੇ ਛੋਟੇ ਛੋਟੇ ਹੁੰਦੇ ਹਨ ਤਾਂ ਉਹਨਾਂ ਨੂੰ ਉਹ ਆਲ੍ਹਣਿਆ ਵਿੱਚ ਦਾਣਾਂ ਪਾਣੀ ਦਿੰਦੇ ਹਨ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਉੱਡ ਜਾਂਦੇ ਹਨ ਫਿਰ ਉਹ ਵੀ ਆਪਣੇ ਅਲੱਗ ਅਲੱਗ ਜਗ੍ਹਾ 'ਤੇ ਛੋਟੇ ਛੋਟੇ ਆਲ੍ਹਣੇ ਅਲੱਗ ਅਲੱਗ ਜਗ੍ਹਾ 'ਤੇ ਦਰੱਖਤਾਂ 'ਤੇ ਘਰਾਂ 'ਤੇ ਘਰਾਂ ਦੇ ਰੋਸ਼ਨਦਾਨਾਂ 'ਤੇ ਖਿੜਕੀਆਂ 'ਤੇ ਆਪਣੇ ਆਲ੍ਹਣੇ ਬਣਾ ਲੈਂਦੇ ਹਨ